ਹਾਂਜੀ ਹਾਂਜੀ ਹਾਂਜੀ ਦੱਸੋ ਮੈਮ ਹਾਂਜੀ ਓਕੇ ਓਕੇ ਜੀ ਆਪਣੇ ਨਾ ਬਰਨਾਲੇ ਦੇ ਵਿੱਚ ਇੱਥੇ ਸ਼੍ਰੀ ਰਾਮ ਗਾਰਡਨ ਹੈਗਾ ਜੀ ਅਤੇ ਬਹੁਤ ਵਧੀਆ ਅਤੇ ਮਸ਼ਹੂਰ ਵੀ ਬਹੁਤ ਹੈ ਜੀ ਜਿਹਦੇ ਵਿੱਚ ਤੁਹਾਨੂੰ ਮੰਨ ਕੇ ਚੱਲੋ ਜੀ ਸਵੀਮਿੰਗ ਪੂਲ ਆ ਜਾਂਦਾ ਜੀ ਗਰਮੀ ਦੇ ਵਿੱਚ ਨਹਾਉਣ ਵਾਸਤੇ ਵਧੀਆ ਅਤੇ ਉਹਦੇ ਵਿੱਚ ਮੰਨ ਕੇ ਚੱਲੋ ਵੀ ਡੇਲੀ ਦਾ ਪੰਜਾਹ ਸੱਠ ਲੀਟਰ ਪਾਣੀ ਆਪਾਂ ਮੰਨ ਕੇ ਚੱਲੋ ਡੇਲੀ ਡੇਲ ਡੇਲੀ ਚੇਂਜ ਹੁੰਦਾ ਜੀ ਇਹ ਨਹੀਂ ਹੈਗਾ ਜੀ ਉਹਦਾ ਉਹ ਗੰਦਾ ਪਾਣੀ ਉੱਦਾਂ ਹੀ ਰਹੇ ਅਤੇ ਉਹ ਪਾਣੀ ਆਪਾਂ ਡੇਲੀ ਦਾ ਡੇਲੀ ਚੇਂਜ ਕਰੀਦਾ ਜੀ ਅਤੇ ਝੂਲੇ ਹੈਗੇ ਜੀ ਵਧੀਆ ਫਰੈਸ਼ ਹੈਗੇ ਹਾਂਜੀ ਅਤੇ ਰਨਵੇ ਹੈਗਾ ਰੇਸਿੰਗ ਲ ਰੇਸਿੰਗ ਦੇ ਲਈ ਹਾਂ ਜਿਹਦੇ ਵਿੱਚ ਤੁਹਾਨੂੰ ਉਹਨਾਂ ਦਾ ਬ ਥੋੜ੍ਹਾ ਬਹੁਤ ਕੋਸਟ ਕਰਨਾ ਪੈਂਦਾ ਕੋਈ ਜ਼ਿਆਦਾ ਨਹੀਂ ਕਰਨਾ ਪੈਂਦਾ ਅਤੇ ਬੱਚੇ ਵਧੀਆ ਇੰਜੋਆਏਮੇਂਟ ਪੂਰਾ ਵਧੀਆ ਹੁੰਦਾ ਗਾ ਅਤੇ ਤੁਸੀਂ ਇੱਕ ਵਾਰ ਆਇਓ ਵਿਜਿਟ ਕਰਿਓ ਤੁਹਾਨੂੰ ਵਧੀਆ ਲੱਗੇਗਾ ਤੁਸੀਂ ਫੇਰ ਤੋਂ ਆਉਗੇ ਅਤੇ ਆਪਣੇ ਹੋਰ ਬਹੁਤ ਸਾਰੀਆਂ ਹੈਗੀਆਂ ਜੀ ਅਤੇ ਜਿਵੇਂ ਛੋਟੇ ਬੱਚਿਆਂ ਲਈ ਅਲੱਗ ਤੋਂ ਹੈ ਵੱਡਿਆਂ ਲਈ ਅਲੱਗ ਤੋਂ ਹੈ ਅਤੇ ਇਸ ਲਈ ਇੱਦਾਂ ਕੋਈ ਉਹ ਨਹੀਂ ਹੈਗਾ ਵੀ ਵੀ ਸੱਟ ਵਗੈਰਾ ਲੱਗਣ ਦਾ ਚਾਂਸ ਵੀ ਬਹੁਤ ਘੱਟ ਹੈਗੇ ਅਤੇ ਤੁਹਾਨੂੰ ਤੁਹਾਨੂੰ ਫੇਰ ਪਤਾ ਲੱਗ ਜੂਗਾ ਵੀ ਹਾਂਜੀ ਕਿੱਦਾਂ ਕਿੱਦਾਂ ਸਿਸਟਮ ਨਹੀਂ ਹੈ ਅਤੇ ਬਹੁਤ ਵਧੀਆ ਹੈਗਾ ਬਹੁਤ ਲੋਕ ਦੂਰੋਂ ਦੂਰੋਂ ਆਉਂਦੇ ਵੀ ਹੈ ਅਤੇ ਤੁਸੀਂ ਇੱਕ ਵਾਰ ਆ ਕੇ ਆਪਣੀ ਜੋ ਟਿਕਟ ਵਗੈਰਾ ਹੀ ਹੈ ਅਤੇ ਉਹਨੂੰ ਤੁਸੀਂ ਬੁੱਕ ਕਰਵਾ ਜਿਓ ਜਾਂ ਔਨਲਾਈਨ ਦੇਖ ਲਿਓ ਔਨਲਾਈਨ ਹੋ ਜੂਗੀ ਫੀਸ ਆਪਣੀ ਸੱਤ ਸਾਲ ਦੇ ਬੱਚੇ ਦੀ ਹੈਗੀ ਹੈ ਜੀ ਸਾਢੇ ਕੁ ਪੰਜ ਸੌ ਅਤੇ ਆਪਣਾ ਇੱਕ ਅੱਠ ਸਾਲ ਦਾ ਦਸ ਸਾਲ ਦਾ ਜੀ ਬੇਟਾ ਹਾਂਜੀ ਉਹਨਾਂ ਦੀ ਤੁਹਾਡੀ ਨ ਹੋ ਜੂਗੀ ਸਾਢੇ ਕੁ ਅੱਠ ਸੌ ਰੁਪਈਆ ਜੀ ਹਾਂਜੀ ਅਤੇ ਤੁਸੀਂ ਔਨਲਾਈਨ ਦੇਖ ਲਿਓ ਜੇ ਤਾਂ ਔਨਲਾਈਨ ਹੋ ਗਈ ਠੀਕ ਹੈ ਨਹੀਂ ਤੁਸੀਂ ਇੱਥੇ ਆ ਜਿਓ ਇੱਥੇ ਆ ਕੇ ਅਤੇ ਇੱਥੇ ਆ ਕੇ ਆਪਣੇ ਬੁੱਕ ਕਰਵਾ ਜਿਓ ਟਾਈਮ ਲੈ ਜਿਓ ਤੁਸੀਂ ਅਤੇ ਅਸੀਂ ਤੁਹਾਨੂੰ ਦੱਸ ਦਿਆਂਗੇ ਅਤੇ ਉਸ ਟਾਈਮ ਤੁਸੀਂ ਆ ਜਿਓ ਕੋਈ ਉਹ ਨਹੀਂ ਹੈਗਾ ਅਤੇ ਨਹਾਉਣ ਵਾਸਤੇ ਵਧੀਆ ਅਤੇ ਤੁਹਾਨੂੰ ਆਪਣੇ ਬੱਚਿਆਂ ਲਈ ਅਲੱਗ ਤੋਂ ਕੱਪੜੇ ਦਿੱਤੇ ਜਾਣਗੇ ਅਤੇ ਵਧੀਆ ਇਹਦੇ ਵਿੱਚ ਤੁਸੀਂ ਆਪਦਾ ਬੱਚੇ ਸਵਿਮਿੰਗ ਕਰ ਸਕਦੇ ਆ ਜੀ ਅਤੇ ਰੇਸਿੰਗ ਵਗੈਰਾ ਹੈਗੀ ਹੈ ਅਤੇ ਝੂਲੇ ਵਗੈਰਾ ਵੀ ਵਧੀਆ ਹੈਗੇ ਗੇ ਅਤੇ ਟਹਿਲਣ ਵਾਸਤੇ ਵਧੀਆ ਚੰਗਾ ਗਾਰਡਨ ਵੀ ਬਣਾਇਆ ਹੋਇਆ ਜਿੱਥੇ ਵਧੀਆ ਪੇੜ ਪੌਦੇ ਹੈਗੇ ਗੇ ਪ੍ਰਦੂਸ਼ਣ ਵਾਲਾ ਸਿਸਟਮ ਨਹੀਂ ਹੈਗਾ ਜੀ ਹਰਿਆਲੀ ਹਰਿਆਲੀ ਹੈ ਆਪਣੇ ਇੱਥੇ ਬੱਚਿਆਂ ਨੂੰ ਵਧੀਆ ਇੰਜੋਆਏਮੈਂਟ ਹੋਊਗਾ ਹਾਂਜੀ ਹਾਂਜੀ ਹਾਂਜੀ ਇਸ 'ਤੇ ਕਰ ਲਿਓ ਜੀ ਠੀਕ ਹੈ ਜੀ